ਅਠਾਈ ਸਤੰਬਰ ਉੱਨੀ ਸੌ ਛਿਆਨਵੇਂ ਦੋ ਜੂਨ ਦੋ ਹਜ਼ਾਰ ਚਾਰ ਪੰਦਰਾਂ ਮਈ ਦੋ ਹਜ਼ਾਰ ਤੇਈ ਇੱਕ ਜਨਵਰੀ ਉੱਨੀ ਸੌ ਨੜਿਨਵੇਂ ਇਕੱਤੀ ਫਰਵਰੀ ਦੋ ਹਜ਼ਾਰ ਦਸ